ਮੇਰੀ ਜ਼ਿੰਦਗੀ ਦੀ ਪਿਛਲੇ ਸਾਲ ਦੀ ਯਾਦਗਾਰੀ ਘਟਨਾ ਮੇਰੇ ਛੋਟੇ ਭਰਾ ਦਾ ਵਿਆਹ ਵਾਲਾ ਦਿਨ ਸੀ ਉਸ ਦਿਨ ਅਸੀਂ ਸਾਰੇ ਯਾਰ ਦੋਸਤ ਰਿਸ਼ਤੇਦਾਰ ਮਿੱਤਰ ਸਾਕ ਸੰਬੰਧੀ ਇਕੱਠੇ ਹੋਏ ਸਨ ਅਤੇ ਉਸ ਦਿਨ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਖਾਣ ਪੀਣ ਤੋ ਲੈ ਕੇ ਪਹਿਨ ਕੱਪੜੇ ਪਹਿਨਣ ਤੱਕ ਬਹੁਤ ਵਧੀਆ ਦਿਨ ਇੰਜੋਏ ਕੀਤਾ ਸਾਰਿਆਂ ਨੇ ਰਲ ਕੇ ਸ਼ਾਮ ਸ਼ਾਮੀ ਭੰਗੜਾ ਪਾਇਆ ਭੰਗੜਾ ਪਾਇਆ ਅਤੇ ਸਾਰਿਆਂ ਨੇ ਉਸ ਦਿਨ ਨੂੰ ਬਹੁਤ ਇੰਜੋਏ ਮੈਂ ਇਸ ਦਿਨ ਨੂੰ ਆਪਣਾ ਪਿਛਲੇ ਸਾਲ 'ਚ ਯਾਦਗਾਰੀ ਦਿਨ ਮੰਨਦਾ ਹਾਂ